ਸਵੈ ਪ੍ਰਗਟਾਵੇ ਅਤੇ ਭਾਵਨਾਤਮਕ ਰਿਹਾਈ ਲਈ ਇੱਕ ਸ਼ਕਤੀਸ਼ਾਲੀ ਆਊਟਲੇਟ ਪ੍ਰਦਾਨ ਕਰਕੇ ਡਾਂਸ ਨੇ ਮੇਰੇ ਜੀਵਨ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ ਡਾਂਸ ਦੁਆਰਾ ਮੈਂ ਭਾਵਨਾਵਾਂ ਨੂੰ ਸੰਚਾਰ ਕਰਨ ਦਾ ਇੱਕ ਵਿਲੱਖਣ ਤਰੀਕਾ ਲੱਭਿਆ ਹੈ ਜਿਸ ਨੂੰ ਸ਼ਬਦ ਕਦੇ ਕਦੇ ਹਾਸਲ ਨਹੀਂ ਕਰ ਸਕਦੇ ਡਾਂਸ ਦੀ ਭੌਤਿਕਤਾ ਮੇਰੀ ਸਮੁੱਚੀ ਤੰਦਰੁਸਤੀ ਵਿੱਚ ਸੁਧਾਰ ਕਰਦੇ ਹੋਏ ਕਿਰਿਆਸ਼ੀਲ ਅਤੇ ਸਿਹਤਮੰਦ ਰਹਿਣ ਵਿੱਚ ਮੇਰੀ ਮਦਦ ਕਰਦੀ ਹੈ ਇਸ ਨੇ ਅਨੁਸ਼ਾਸਨ ਅਤੇ ਸਮਰਪਣ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕੀਤਾ ਹੈ ਕਿਉਂਕਿ ਕੋਰੀਓਗ੍ਰਾਫੀ ਅਤੇ ਤਕਨੀਕ ਵਿੱਚ ਮਾਹਰਤ ਹਾਸਲ ਕਰਨ ਲਈ ਲਗਨ ਅਤੇ ਫੋਕਸ ਦੀ ਲੋੜ ਹੁੰਦੀ ਹੈ ਇਸ ਤੋਂ ਇਲਾਵਾ ਡਾਂਸ ਨੇ ਮੈਨੂੰ ਇੱਕ ਸਹਾਇਕ ਕਮਿਊਟੀਂਟੀ ਨਾਲ ਜੋੜਿਆ ਹੈ ਸਥਾਈ ਦੋਸਤੀ ਬਣਾਉਣ ਅਤੇ ਸਮਾਨ ਜਨੂੰਨ ਸਾਂਝੇ ਕਰਨ ਵਾਲੇ ਦੂਜਿਆਂ ਨਾਲ ਸਹਿਯੋਗ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ ਕੁੱਲ ਮਿਲਾ ਕੇ ਡਾਂਸ ਨੇ ਮੇਰੀ ਸਰੀਰਕ ਸਿਹਤ ਨੂੰ ਵਧਾ ਕੇ ਮੇਰੇ ਆਤਮ ਵਿਸ਼ਵਾਸ ਨੂੰ ਵਧਾ ਕੇ ਅਤੇ ਆਪਣੇ ਆਪ ਦੀ ਮਜ਼ਬੂਤ ਭਾਵਨਾ ਪੈਦਾ ਕਰਕੇ ਮੇਰੀ ਜ਼ਿੰਦਗੀ ਨੂੰ ਅਮੀਰ ਬਣਾਇਆ ਹੈ